ਨਿਊਜ਼ ਮੀਡੀਆ ਸਾਡੇ ਕਾਰੋਬਾਰ ਨੂੰ ਅੱਗੇ ਕਰਨ ਵਿੱਚ ਇਸ ਲਈ ਮਦਦ ਕਰਦੀ ਹੈ ਕਿਉਂਕਿ ਨਿਊਜ਼ 'ਤੇ ਸਾਨੂੰ ਜੋ ਵੀ ਕੋਈ ਨਵੇਂ ਉਦਯੋਗ ਜਿਵੇਂ ਕਿ ਕੋਈ ਵੀ ਨਵੀਂ ਮਸ਼ੀਨ ਕੋਈ ਵੀ ਨਵਾਂ ਕੰਮ ਹੋਵੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਇਸ ਲਈ ਸਾਨੂੰ ਨਿਊਜ਼ ਤੋਂ ਬੜਾ ਕੁਛ ਪਤਾ ਚੱਲਦਾ ਹੈ ਇਸ ਲਈ ਸਾਡੇ ਲ ਤੱਕ ਪਹਿਲਾਂ ਜੋ ਚੀਜ਼ ਪਹੁੰਚਦੀ ਹੈ ਉਹ ਸਾਨੂੰ ਨਿਊਜ਼ ਵਿੱਚ ਹੀ ਪਤਾ ਚੱਲ ਜਾਂਦੀ ਹੈ ਅਤੇ ਇਹ ਸਾਡੇ ਕਾਰੋਬਾਰ ਵਿੱਚ ਵੀ ਬਹੁਤ ਸਹਾਇਤਾ ਕਰਦੀ ਹੈ ਇਸ ਲਈ ਇਹ ਨਿਊਜ਼ ਸਾਡੇ ਲਈ ਬਹੁਤ ਸਹਾਇਕ ਹੁੰਦੀਆਂ ਹਨ